ਰੇਡੀਓ ਸਟੇਸ਼ਨ 'ਤੇ ਮੈਨੂੰ ਕੋਈ ਵੀ ਪ੍ਰੋਗਰਾਮ ਪਸੰਦ ਨਹੀਂ ਹੈ ਜੇਕਰ ਟੀ ਵੀ ਦੀ ਗੱਲ ਕੀਤੀ ਜਾਵੇ ਤਾਂ ਟੀ ਵੀ ਵਿੱਚ ਬਹੁਤ ਸਾਰੇ ਪ੍ਰੋਗਰਾਮ ਹਨ ਜੋ ਮੈਨੂੰ ਪਸੰਦ ਹਨ ਜਿਵੇਂ ਡੋਰੀਮੋਨ ਬੈਨ ਟੈਂਨ ਸ਼ਿਵਾਜੀ ਇਹ ਸਾਰੇ ਪ੍ਰੋਗਰਾਮ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹਨ ਜਿਨ੍ਹਾਂ ਵਿੱਚੋਂ ਡੋਰੀਮੋਨ ਦੀ ਗੱਲ ਕੀਤੀ ਜਾਵੇ ਉਹ ਇੱਕ ਤਾਂ ਉਹਦੇ ਵਿੱਚ ਐਂਟਰਟੇਨਮੈਂਟ ਬਹੁਤ ਹੁੰਦਾ ਹੈ ਬਹੁਤ ਹੀ ਵਧੀਆ ਹੁੰਦਾ ਹੈ ਜਿਹਨੂੰ ਦੇਖਣ ਦੇ ਨਾਲ ਜਿਹੜਾ ਦਿਮਾਗ ਆ ਉਹ ਵੀ ਫਰੈਸ਼ ਹੋ ਜਾਂਦਾ ਹੈ ਡੋਰੇਮੋਨ ਇੱਕ ਅਜਿਹਾ ਕਾਟੂਨ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕਿੱਦਾਂ ਇੱਕ ਦੋਸਤ ਦੂਸਰੇ ਦੋਸਤ ਦੀ ਮਦਦ ਕਰਦਾ ਹੈ ਜੇਕਰ ਕੋਈ ਇੱਕ ਦੋਸਤ ਮੁਸੀਬਤ ਵਿੱਚ ਫਸਿਆ ਹੋਵੇ ਤਾਂ ਦੂਜੇ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਇਹ ਉਸ ਪ੍ਰੋਗਰਾਮ ਵਿੱਚ ਦੱਸਿਆ ਗਿਆ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਕਿ ਸਾਨੂੰ ਕਿਸ ਤਰ੍ਹਾਂ ਆਪਣੇ ਇੱਕ ਦੋਸਤ ਨੂੰ ਦੂਜੇ ਦੋਸਤ ਦੀ ਮਦਦ ਕਰਨੀ ਚਾਹੀਦੀ ਹੈ ਜੋ ਕਿ ਇੱਕ ਮੁਸੀਬਤ ਵਿੱਚ ਫਸਿਆ ਹੁੰਦਾ ਹੈ ਸਾਨੂੰ ਉਸ ਪ੍ਰੋਗਰਾਮ ਤੋਂ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਨਾਲੇ ਆਪਣੇ ਦੋਸਤ ਦੀ ਮਦਦ ਕਰ ਸਕੀਏ